ਅਧਿਆਪਕ ਕਿੱਤਾ ਹੋਣ ਦੇ ਕਾਰਨ ਸਾਨੂੰ ਕਈ ਵਾਰ ਲਾਗੇ ਲਾਗੇ ਪਿੰਡਾਂ ਦੇ ਵਿੱਚ ਸਕੂਲ ਵੱਲੋਂ ਕਈ ਵਾਰ ਗਰੁੱਪ ਬਣਾ ਕੇ ਭੇਜਿਆ ਜਾਂਦਾ ਹੈ ਕੋਈ ਉਦੇਸ਼ ਦੀ ਪੂਰਤੀ ਕਰਨ ਵਾਸਤੇ ਸੋ ਮੇਰਾ ਤਜ਼ਰਬਾ ਸੀਗਾ ਕਿ ਜਦੋਂ ਅਸੀਂ ਗਏ ਸੀਗੇ ਅਤੇ ਅਸੀਂ ਦੇਖਿਆ ਕਿ ਆਮ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਰੂੜ੍ਹੀਵਾਦੀ ਸੋਚ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਕਹਿੰਦੇ ਨੇ ਕਿ ਕੁੜੀਆਂ ਨੂੰ ਨਹੀਂ ਪੜ੍ਹਾਉਣਾ ਮੁੰਡਿਆਂ ਨੂੰ ਪੜ੍ਹਾਉਣਾ ਜ਼ਰੂਰੀ ਹੈ ਸੋ ਸਾਡਾ ਇਹੀ ਉਦੇਸ਼ ਸੀਗਾ ਜਦੋਂ ਅਸੀਂ ਦੌਰਾ ਕੀਤਾ ਅਤੇ ਅਸੀਂ ਆ ਆਪਸ ਦੇ ਵਿੱਚ ਸਲਾਹ ਕੀਤੀ ਟੀਮ ਨੇ ਕਿ ਥੋੜ੍ਹਾ ਜਿਹਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜਦੋਂ ਅਸੀਂ ਪਿੰਡਾਂ 'ਚ ਗਏ ਸੀਗੇ ਤਾਂ ਉੱਥੇ ਬਹੁਤ ਜ਼ਿਆਦਾ ਮਤਲਬ ਗਰੀਬੀ ਰੇਖਾ ਵੀ ਵੇਖੀ ਜਾਂਦੀ ਹੈ ਅਤੇ ਗਰੀਬ ਸੀ ਲੋਕ ਅਤੇ ਉਹਨਾਂ ਨੂੰ ਸੀਗਾ ਕੁੜੀਆਂ ਨੂੰ ਪੜ੍ਹਾ ਕੇ ਕੀ ਕਰਨਾ ਆ ਕਿ ਇਹਨਾਂ ਨੂੰ ਵਿਆਹ ਕੇ ਅਤੇ ਚਲੋ ਕੰਮ ਖਤਮ ਕਰੀਏ ਪਰ ਜਦੋਂ ਅਸੀਂ ਗਏ ਉੱਥੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਕਿ ਕੁੜੀਆਂ ਨੂੰ ਪੜ੍ਹਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੂੰ ਪੈਰਾਂ 'ਤੇ ਖੜ੍ਹੇ ਕਰਨਾ ਜ਼ਰੂਰੀ ਹੈ ਅਤੇ ਜਦੋਂ ਅਸੀਂ ਇਹ ਸਾਰਿਆਂ ਨੇ ਮਿਲ ਕੇ ਕੰਮ ਸ਼ੁਰੂ ਕੀਤਾ ਅਤੇ ਪਿੰਡ ਵਾਲਿਆਂ ਨੇ ਸਾਡੀ ਕਾਫੀ ਮਤਲਬ ਕਿ ਸਿਫਤ ਕੀਤੀ ਸਾਨੂੰ ਉਤਸ਼ਾਹ ਕੀਤਾ ਸਾਨੂੰ ਜਾਗਰੂਕ ਮਤਲਬ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਨੂੰ ਬਹੁਤ ਜਾਗਰੂਕ ਕੀਤਾ ਆ ਇਹਦੇ ਪ੍ਰਤੀ ਸੋ ਉਹਨਾਂ ਨੇ ਫਿਰ ਆਪਣੀ ਜਿਹੜੀ ਸੋਚ ਹੈ ਥੋੜ੍ਹੀ ਬਦਲੀ ਅਤੇ ਉਹਨਾਂ ਨੇ ਮਤਲਬ ਕਿ ਸਾਡੇ ਸਕੂਲ ਆ ਕੇ ਸਾਡੇ ਸਕੂਲ ਨੂੰ ਵੀ ਧੰਨਵਾਦ ਕੀਤਾ ਅਤੇ ਸਾਨੂੰ ਵੀ ਨਾਲ ਉਤਸ਼ਾਹਿਤ ਕੀਤਾ ਨਾਲ ਸਾਡੇ ਪ੍ਰਬੰਧਕਾਂ ਨੂੰ ਉਤਸ਼ਾਹਿਤ ਕੀਤਾ ਕਿ ਬਹੁਤ ਵਧੀਆ ਤੁਹਾਡਾ ਜਿਹੜਾ ਉਦੇਸ਼ ਹੈ ਕਿ ਤੁਹਾਡੇ ਜਿਹੜੇ ਟੀਚਰ ਨੇ ਜਾਂ ਅਧਿਆਪਕ ਨੇ ਜਾ ਕੇ ਘਰ ਘਰ ਲੋਕਾਂ ਨੂੰ ਜਾਗਰੂਕ ਕਰਦੇ ਨੇ ਸੋ ਸਾਡਾ ਮੇਨ ਉਦੇਸ਼ ਇਹੀ ਹੁੰਦਾ ਆ ਅਧਿਆਪਕਾਂ ਦਾ ਕਿ ਸਾਰਿਆਂ ਨੂੰ ਜਿਹੜੀ ਐਜੂਕੇਸ਼ਨ ਹੈ ਉਹ ਬਰਾਬਰ ਮਿਲਣੀ ਚਾਹੀਦੀ ਹੈ ਸੋ ਧੰਨਵਾਦ